ਹੈਲੋ ਮੈਮ ਆਸਥਾ ਨਰਸ ਹੋਸਪੀਟਲ ਤੋਂ ਬੋਲ ਰਹੇ ਹੋ ਹੈਲਥ ਕੇਅਰ ਤੋਂ ਓਕੇ ਮੈਮ ਮੈਮ ਸਾਨੂੰ ਮੇਰੇ ਗਰੈਂਡ ਫਾਦਰ ਦੇ ਲਈ ਹੈਲਥ ਕੇਅਰ ਇੱਕ ਨਰਸ ਦੀ ਲੋੜ ਸੀਗੀ ਹਾਂਜੀ ਮੈਮ ਮੇਰੇ ਜਿਹੜੇ

ਮੈਮ ਮੇਰੇ ਜਿਹੜੇ ਗਰੈਂਡ ਫਾਦਰ ਆ ਉਹ ਔਰ ਅਰਾਊਂਡ ਟਵਨ ਅਰਾਊਂਡ ਨਾਇਟੀ ਸੈਵਨ ਈਅਰ ਦੇ ਆ ਅਤੇ ਉਹਨਾਂ ਨੂੰ ਥੋੜ੍ਹਾ ਮਿਸਟਰ ਅੰਗਰੇਜ਼ ਸਿੰਘ ਮੈਮ ਹਾਂਜੀ ਨਾਈਟੀ ਸੈਵਨ ਈਅਰ ਓਲਡ ਆ ਉਹਨਾਂ ਦੀ ਮੈਮ ਉਹ ਇੱਕ ਤਾਂ ਉਹਨਾਂ ਦੀ ਸ਼ੂਗਰ ਦੀ ਪ੍ਰੋਬਲਮ ਆ ਔਰ ਇੱਕ ਉਹਨਾਂ ਦਾ ਬੀ ਪੀ ਵੀ ਅਪ ਡਾਊਨ ਰਹਿੰਦਾ ਐਂਡ ਮੈਮ ਸਮਟਾਈਮ ਕੀ ਉਹਨਾਂ ਨੂੰ ਥੋੜ੍ਹਾ ਹੈ ਉਹਨਾਂ ਦੇ ਹੈਲਥ ਇਸ਼ੂਜ਼ ਕ੍ਰੀਏਟ ਹੋਏ ਹੀ ਰਹਿੰਦੇ ਆ ਥੋੜ੍ਹੇ ਥੋੜ੍ਹੇ ਟਾਈਮ ਤੱਕ ਬੀ ਪੀ ਦੀ ਪ੍ਰੋਬਲਮ ਹੋ ਗਈ ਸ਼ੂਗਰ ਦਾ ਲੈਵਲ ਹੋ ਗਿਆ ਔਰ ਮੈਮ ਰੀਸੈਂਟਲੀ ਉਹਨਾਂ ਦੇ ਥੋੜ੍ਹੀ ਸੱਟ ਲੱਗ ਗਈ ਸੀਗੀ ਉਹ ਡਿੱਗ ਗਏ ਸੀਗੇ ਅਤੇ ਉਹਨਾਂ ਦੀ ਥ੍ਰੀ ਟੈਮ ਡਰੈਸਿੰਗ ਕਰਨੀ ਪੈਂਦੀ ਆ ਉਹਨਾਂ ਦੇ ਲੈਗ 'ਚ ਸੱਟ ਲੱਗ ਗਈ ਸੀਗੀ ਤਾਂ ਉਹਨਾਂ ਦੀ ਮਤਲਬ ਇੱਕ ਉਹਨਾਂ ਦਾ ਡੇਲੀ ਟੂ ਟਾਈਮ ਆ ਜਿਹੜਾ ਬੀ ਪੀ ਵੀ ਚੈੱਕ ਕਰਨਾ ਪੈਂਦਾ ਔਰ ਟੈਕਸ ਦੀ ਮੈਮ ਮੈਮ ਉਹ ਮੋਸਟ ਓਫ ਦਾ ਟਾਈਮ ਉਹ ਬੈਡ ਰੈਸਟ 'ਤੇ ਹੁੰਦੇ ਆ ਬਟ ਯਾਨੀ ਕਿ ਈਵਨਿੰਗ ਟਾਈਮ ਆਪਾਂ ਕਹਿ ਸਕਦੇ ਹਾਂ ਥੋੜ੍ਹਾ ਉਹਨਾਂ ਨੂੰ ਥੋੜ੍ਹ ਹੈਲਪ ਨਾਲ ਅਸਿਸਟੈਂਟ ਦੀ ਹੈਲਪ ਨਾਲ ਉਹ ਚੱਲ ਫਿਰ ਸਕਦੇ ਆ ਅਦਰਵਾਈਜ਼ ਥੋੜ੍ਹਾ ਔਖਾਂ ਉਹਨਾਂ ਦਾ ਔਰ ਮੈਮ ਉਹਨਾਂ ਦੀ ਜਿਹੜੀ ਮੈਡੀਸੀਨ ਆ ਉਹ ਉਹਨਾਂ ਨੂੰ ਥ੍ਰੀ ਟਾਈਮ ਪ੍ਰੋਵਾਈਡ ਕਰਵਾਉਣੀ ਪੈਂਦੀ ਆ ਪਲੱਸ ਉਹਨਾਂ ਦਾ ਪ੍ਰੋਪਰ ਜਿਹੜਾ ਮੀਲ ਬਣਦਾ ਵਾ ਖਿਚੜੀ ਹੋ ਗਈ ਜਾਂ ਉਦਾਂ ਜਿਹੜਾ ਉਹਨਾਂ ਦੀ ਪ੍ਰੋਪਰ ਡਾਇਟ ਆ ਜਿਹੜੀ ਉਹਨਾਂ ਦੀ ਲਾਈਟ ਡਾਈਟ ਆ ਉਹ ਦੇਣੀ ਪੈਂਦੀ ਆ ਉਹਦੇ ਲਈ ਸਾਨੂੰ ਚਾਹੀਦਾ ਸੀਗਾ ਨਰਸ ਚਾਹੀਦੀ ਸੀਗੀ ਪ੍ਰੋਪਰ ਉਹਨਾਂ ਦੇ ਪਲੱਸ ਮੈਡੀਕਲ ਪਲੱਸ ਹੈਲਥ ਕੇਅਰ ਸਾਰਾ ਉਹਨਾਂ ਦੇ ਖਾਣੇ ਦਾ ਸਾਰਾ ਇੰਤਜ਼ਾਮ ਕਰ ਸਕੇ ਨੋ ਮੈਮ ਸਾਨੂੰ ਪ੍ਰੋਪਰ ਟ ਟਵੰਟੀ ਫੋਰ ਆਵਰ ਚਾਹੀਦੇ ਆ ਔਰ ਉਹ ਜਿਹੜਾ ਉਹਦੇ ਰਹਿਣ ਦਾ ਇੰਤਜ਼ਾਮ ਹੋਊਗਾ ਉਹ ਅਸੀਂ ਆਪਣੇ ਘਰ ਵਿੱਚ ਹੀ ਕਰਾਂਗੇ ਔਰ ਮੈਮ ਓਕੇ ਮੈਮ ਮੈਮ ਤੁਹਾਡੇ ਕੋਲ ਅਸਿਸਟੈਂਟ ਅਵੇਲੇਬਲ ਹੈਗਾ ਜਿਹੜਾ ਸਾਡੇ ਲਈ ਟਵੰਟੀ ਫੋਰ ਆਵਰਸ ਨਿਕਾਲ ਸਕੇ ਓਕੇ ਮੈਮ ਮੈਮ ਤੁਹਾਡੇ ਕੋਲ ਅਵੇਲੇਬਿਲਟੀ ਕਾਹਦੀ ਆ ਬੋਆਇਜ਼ ਦੀ ਜਾਂ ਗਰਲਸ ਦੀ ਆ ਕਿ ਬੋਥ ਆ ਤੁਹਾਡੇ ਕੋਲ ਮੈਮ ਆਈ ਥਿੰਕ ਬੋਆਏ ਬੈਸਟ ਰਹੂਗਾ ਕਿਉਂਕਿ ਉਹ ਮੇਲ ਆ ਐਂਡ ਮੇਲ ਨਾਲ ਫਿਰ ਮੇਲ ਦਾ ਕੰਟੈਕਟ ਕਾਫੀ ਅੱਛਾ ਹੋਊਗਾ ਤਾਂ ਤੁਸੀਂ ਮੇਲ ਦਾ ਹੀ ਕਰ ਦਓ ਮੈਮ ਤੁਹਾਡਾ ਟਵੰਟੀ ਫੋਰ ਆਵਰ ਦਾ ਸਟਾਰਟਿੰਗ ਪੈਕੇਜ ਕਿੱਥੋਂ ਦਾ ਕਿੱਥੋਂ ਸਟਾਰਟ ਹੋ ਰਿਹਾ ਹਾਂਜੀ ਹਾਂਜੀ ਓਕੇ ਓਕੇ ਓਕੇ ਓਕੇ ਮੈਮ ਡਨ ਸਾਨੂੰ ਤੁਹਾਡਾ ਇਹ ਮਨਜ਼ੂਰ ਆ ਔਰ ਮੈਮ ਇਹ ਕਦੋਂ ਤੋਂ ਤੁਸੀਂ ਭੇਜ ਰਹੇ ਹੋ ਓਕੇ ਮੈਮ ਥੈਂਕ ਯੂ ਸੋ ਮੱਚ ਅਸੀਂ ਤੁਹਾਨੂੰ ਡਿਸਾਈਡ ਕਰਕੇ ਦੱਸ ਦਿੰਦੇ ਓਕੇ ਮੈਮ